ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਆ ਹਾਲ ਚਾਲ ਵਧੀਆ ਸਾਡਾ ਵੀ ਕਿਆ ਕਰਦੇ ਤੇ ਅੱਛਾ ਅੱਛਾ ਅੱਜ ਕਿਆ ਗੱਲ ਕੋਈ ਪ੍ਰੋਗਰਾਮ ਅੱਛਾ ਬਾਹਰ ਕੋਈ ਨਹੀਂ ਅੱਛੇ ਬਥੇਰੇ ਹੈਗੇ ਆ ਅੱਛੇ ਉਰੇ ਮੋਹਾਲੀ ਹੈਗੇ ਆ ਭੈਣਾਂ ਦਾ ਢਾਬਾ ਕਟਾਣੀ ਰੈਸਟੋਡੈਂਟ ਹੈਂ ਉਨ੍ਹਾਂ ਦੇ ਤਾਂ ਸੌ ਦੀ ਪਤਾ ਨਹੀਂ ਇੱਕ ਸੌ ਵੀਹ ਰੁਪਏ ਦੀ ਥਾਲੀ ਹੈ ਜਿੰਨਾਂ ਮਰਜ਼ੀ ਖਾਓ ਜੋ ਮਰਜ਼ੀ ਖਾਣ ਨੂੰ ਹਾਂ ਬਹੁਤ ਚੀਜ਼ਾਂ ਹੁੰਦੀਆਂ ਉਨ੍ਹਾਂ ਦੀਆਂ ਤਾਂ ਸਵਾਦ ਵੀ ਬਹੁਤ ਹੁੰਦੀਆਂ ਹਾਂ ਕਟਾਣੀ ਵਾਲਿਆਂ ਦਾ ਹੈਗਾ ਏ ਇੱਕ ਹਵੇਲੀ ਵੀ ਹੈਗੀ ਹੈ ਜੇ ਹਵੇਲੀ ਮ ਜਾਣਾ ਹਵੇਲੀ ਵਿੱਚ ਵੀ ਇਹ ਖਾਣਾ ਹੀ ਆ ਉਨ੍ਹਾਂ ਦਾ ਵੀ ਖਾਣਾ ਵਧੀਆ ਹੁੰਦਾ ਜਿਵੇਂ ਘਰ ਬਣਾਉਂਦੇ ਆਪਾਂ ਇੱਕ ਖਾਲਸਾ ਸਵੀਟਸ ਵੀ ਹੈਗਾ ਅੰਮ੍ਰਿਤ ਵਾਲਿਆਂ ਦਾ ਹੈਗਾ ਬਹੁਤ ਸਾਰੇ ਹੈਗੇ ਆ ਦੱਸੋ ਤੁਸੀਂ ਖਾਣਾ ਕਿਆ ਤੁਸੀਂ ਜੇ ਤਾਂ ਕੋਈ ਭਟੂਰੇ ਭਟਾਰੇ ਖਾਣੇ ਹੈ ਤਾਂ ਵੀ ਦੱਸੋ ਪੂਰੀਆਂ ਪਾਰੀਆਂ ਉਹ ਵੀ ਬਹੁਤ ਵਧੀਆ ਬਣਾਉਂਦੇ ਉਨ੍ਹਾਂ ਦੇ ਸਿੰਧੀ ਸਵੀਟਸ ਵਾਲਿਆਂ ਦੇ ਹੈ ਦੇਸੀ ਘੀ ਦਾ ਬਣਦਾ ਸਾਰਾ ਉਨ੍ਹਾਂ ਦਾ ਆ ਜਿਓ ਤੁਸੀਂ ਅੱਜ ਏ ਆਉਣਾ ਨਹੀਂ ਆ ਜਿਓ ਅੱਜ ਅਸੀਂ ਵੀ ਫ੍ਰੀ ਹਾਂ ਅਸੀਂ ਚੱਲਾਂਗੇ ਆਪਾਂ ਹੋਰ ਕਿਆ ਘੁੰਮ ਏ ਆਵਾਂਗੇ ਨਾਲੇ ਹਾਂ ਹਾਂ ਬਹੁਤ ਸੁਆਦ ਹੁੰਦੇ ਉਨ੍ਹਾਂ ਦੇ ਛੋਲੇ ਭਟੂਰੇ ਹਾਂ ਹਾਂ ਠੀਕ ਹੈ ਠੀਕ ਹੈ ਚੰਗਾ ਸਤਿ ਸ਼੍ਰੀ ਅਕਾਲ ਓਕੇ ਜੀ